ਅਸੀਂ ਛੋਟੇ ਹੁੰਦੇ ਮਿੱਟੀ ਦੀਆਂ ਮੂਰਤੀਆਂ ਬਣਾਉਂਦੇ ਰਹੇ ਹਾਂ ਮਿੱਟੀ ਦੀਆਂ ਮੂਰਤੀਆਂ ਦੇ ਖਿਡੌਣੇ ਬਣਾਉਂਦੇ ਰਹੇ ਹਾਂ ਜੋ ਕਿ ਸਾਡੇ ਕੋਲ ਅੱਜ ਕੱਲ੍ਹ ਤਾਂ ਮਿੱਟੀ ਦੀਆਂ ਮੂਰਤੀਆਂ ਬਹੁਤ ਵਧੀਆ ਬਣਾਉਂਦੇ ਹਨ ਜਿਸ 'ਤੇ ਰੰਗ ਰੋਗਨ ਬਹੁਤ ਵਧੀਆ ਆਕਰਸ਼ਿਕ ਹੁੰਦੀਆਂ ਜਿਸ ਤਰ੍ਹਾਂ ਅੱਜ ਅੱਜ ਕੱਲ੍ਹ ਰਾਮ ਮੰਦਰ 'ਤੇ ਜਿਵੇਂ ਮੂਰਤੀਆਂ ਬਣਦੀਆਂ ਮੂਰਤੀ ਬਣਾਈ ਹੈ ਰਾਮ ਮੰਦਰ ਦੇ ਵਿੱਚ ਬਹੁਤ ਆਕਰਸ਼ਿਕ ਮੂਰਤੀ ਹੈ ਉਸੇ ਤਰ੍ਹਾਂ ਜਿਹੜੇ ਕਲਾਕਾਰ ਹੈ ਉਹਨਾਂ ਨੂੰ ਬਹੁਤ ਤਜ਼ਰਬਾ ਹੁੰਦਾ ਜੋ ਕਿ ਮੂਰਤੀਆਂ ਬਣਾਨ ਦਾ ਉਹਨਾਂ ਨੂੰ ਇੰਨਾਂ ਤਜ਼ਰਬਾ ਨਹੀ ਹੁੰਦਾ ਪਰ ਸਿਰਫ ਮਿੱਟੀ ਦੀ ਮੂਰਤੀ ਬਣਾ ਕੇ ਛੱਡ ਦਿੰਦੇ ਓ